ਸਾਡੇ ਇਲਾਕੇ ਦੇ ਆਸ ਪਾਸ ਗੰਗਾ ਮਾਤਾ ਗਰਲਜ ਕੋਲਜ ਹੈ ਜਿਸ ਵਿੱਚ ਮੇਰੇ ਵੱਡੇ ਵੀਰ ਦੇ ਬੱਚੇ ਪੜ੍ਹਦੇ ਹਨ ਉਹਨਾਂ ਦੀਆਂ ਕੁੜੀਆਂ ਪੜ੍ਹਦੀਆਂ ਹਨ ਜੋ ਕਿ ਇਸ ਸਮੇਂ ਉੱਥੇ ਬੀ ਸੀ ਏ ਵਿੱਚ ਪੜ੍ਹ ਰਹੀਆਂ ਹਨ